ਜਿੱਦਾਂ ਬਹੁਤ ਸਾਰੀਆਂ ਖੇਡਾਂ ਹਨ ਪਰ ਜਿਹਨਾਂ ਵਿੱਚੋਂ ਜ਼ਿਆਦਾ ਮੈਨੂੰ ਬੋਕਸ ਗੇਮਾਂ ਖੇਡਣੀਆਂ ਹੀ ਪਸੰਦ ਆਉਂਦੀਆਂ ਹਨ ਇਹਨਾਂ ਵਿੱਚ ਕੈਰਮ ਬੋਰਡ ਲੁੱਡੋ ਅਤੇ ਚੈਸ ਵੀ ਹਨ ਇਹਨਾਂ ਵਿੱਚੋਂ ਸਾਰਿਆਂ ਨਾਲੋਂ ਜ਼ਿਆਦਾ ਮੈਨੂੰ ਲੁਡੋ ਗੇਮ ਖੇਲਣੀ ਪਸੰਦ ਹੈ ਇਹਦੇ ਵਿੱਚ ਇੱਕ ਤਾਂ ਇਹ ਫਾਇਦਾ ਕਿ ਅਸੀਂ ਦੋ ਜਾਂ ਦੋ ਤੋਂ ਵੱਧ ਪਲੇਅਰ ਨਾਲ ਗੇਮ ਖੇਲ ਸਕਦੇ ਹਾਂ ਅਤੇ ਜੇ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਬਾਹਰ ਨਿਕਲ ਜਾਂਦਾ ਹੈ ਉਹ ਵਿਨਰ ਹੋ ਜਾਂਦਾ ਹੈ ਅਤੇ ਜਿਹੜਾ ਲਾਸਟ ਵਿੱਚ ਨਿਕਲਦਾ ਹੈ ਉਹ ਚੌਥੇ ਨੰਬਰ 'ਤੇ ਜਾਂ ਤੀਸਰੇ ਨੰਬਰ 'ਤੇ ਆਉਂਦਾ ਹੈ ਠੀਕ ਹੈ ਇਹ ਗੋ ਗੇਮਾਂ ਬਹੁਤ ਵਧੀਆ ਹਨ ਇੱਕ ਤਾਂ ਇਹ ਫਰੀ ਮਾਈਂਡ ਹੋ ਕੇ ਖੇਲਣ ਵਾਲੀਆਂ ਗੇਮਾਂ ਹਨ ਅਤੇ ਇਹਦੇ ਵਿੱਚ ਐਨਰਜੀ ਵੇਸਟਏਜ ਬਹੁਤ ਘੱਟ ਹੁੰਦੀ ਹੈ ਦੂਸਰਾ ਗੱਲ ਇਹ ਫਰੀ ਮਾਈਂਡ ਗੇਮਾਂ ਹਨ ਜਿਹਦੇ ਵਿੱਚ ਜ਼ਿਆਦਾ ਕਿ ਤੁਹਾਨੂੰ ਕੋਈ ਫਿਜੀਕਲ ਐਕਟੀਵਿਟੀ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਹੈ ਠੀਕ ਹੈ ਅਤੇ ਨਾਲ ਹੀ ਨਾਲ ਇਹ ਗੇਮਾਂ ਅਸੀਂ ਕਿਤੇ ਵੀ ਲਿਜਾ ਸਕਦੇ ਹਾਂ ਅਤੇ ਉੱਥੇ ਜਾ ਕੇ ਖੇਲ ਸਕਦੇ ਹਾਂ ਦੂਸਰੀ ਗੱਲ ਇੱਕ ਹੈਗੀ ਆ ਕੈਰਮ ਬੋਰਡ ਇਹ ਗੇਮ ਵੀ ਬਹੁਤ ਵਧੀਆ ਬੋਕਸ ਪਲੇ ਗੇਮ ਹੈ ਇਹਦੇ ਵਿੱਚ ਅਸੀਂ ਚਾਰ ਜਾਣਿਆਂ ਨਾਲ ਖੇਲ ਸਕਦੇ ਹਾਂ ਅਤੇ ਜਿਹਦਾ ਜਿਸ ਜਾਣੇ ਕੋਲ ਜ਼ਿਆਦਾ ਗੀਟੀਆਂ ਹੋਣ ਉਹ ਬੰਦਾ ਸਾਰਿਆਂ ਨਾਲੋਂ ਜ਼ਿਆਦਾ ਵਿਨਰ ਗਿਣਿਆ ਜਾਂਦਾ ਹੈ